ਮੇਰੇ ਪਸੰਦੀਦਾ ਗੀਤ ਪੰਜਾਬੀ ਦੇ ਗੀਤ ਹਨ ਜਿਹੜੇ ਪੰਜਾਬੀ ਦੇ ਲੋਕ ਗੀਤ ਵੀ ਮੰਨੇ ਜਾਂਦੇ ਹਨ ਸ਼ਿਵ ਕੁਮਾਰ ਬਟਾਲਵੀ ਜੀ ਦੇ ਗੀਤ ਸੁਰਿੰਦਰ ਕੌਰ ਪ੍ਰਕਾਸ਼ ਕੌਰ ਦੇ ਗਾਏ ਗੀਤ ਅਤੇ ਆਸਾ ਸਿੰਘ ਮਸਤਾਨਾ ਦੇ ਗਾਏ ਹੋਏ ਸਾਰੇ ਪੰਜਾਬੀ ਦੇ ਲੋਕ ਗੀਤ ਜਿਵੇਂ ਸ਼ਿਵ ਕੁਮਾਰ ਬਟਾਲਵੀ ਜੀ ਦਾ ਬਿਰਹਾ ਦੇ ਬਿਰਵਾਨ ਦੇ ਸਾਰੇ ਗੀਤ ਉਹਨਾਂ ਦਾ ਇੱਕ ਕੁੜੀ ਜਿਹਦਾ ਨਾਮ ਮੁਹੱਬਤ ਉਹ ਗੀਤ ਸੁਰਿੰਦਰ ਕੌਰ ਪ੍ਰਕਾਸ਼ ਕੌਰ ਦੋਵੇਂ ਸਕੀਆਂ ਭੈਣਾਂ ਦੇ ਪੰਜਾਬੀ ਦੇ ਲੋਕ ਗੀਤ ਜਿਵੇਂ ਜੁੱਤੀ ਕਸੂਰੀ ਪੈਰੀ ਨਾ ਪੂਰੀ ਮਾਵਾਂ ਅਤੇ ਧੀਆਂ ਰਲ ਬੈਠੀਆਂ ਨੀ ਮਾਏ ਇਸ ਤਰ੍ਹਾਂ ਆਸਾ ਸਿੰਘ ਮਸਤਾਨਾ ਜੀ ਦੇ ਗਾਏ ਹੋਏ ਗੀਤ ਉਹਨਾਂ ਦੇ ਡਿਊਇਟ ਗੀਤ ਜੋ ਉਹਨਾਂ ਨੇ ਸੁਰਿੰਦਰ ਕੌਰ ਜੀ ਦੇ ਨਾਲ ਗਾਏ ਸੀ ਸੁਰਿੰਦਰ ਕੌਰ ਜੀ ਜਿਨ੍ਹਾਂ ਨੂੰ ਪੰਜਾਬ ਦੀ ਕੋਇਲ ਵਜੋਂ ਵੀ ਜਾਣਿਆ ਜਾਂਦਾ ਹੈ ਇਹਨਾਂ ਸਾਰਿਆਂ ਦੇ ਗੀਤ ਮੇਰੇ ਪਸੰਦੀਦਾ ਗੀਤ ਹਨ ਪਹਿਲਾਂ ਮੈਂ ਛੋਟੇ ਹੁੰਦਿਆਂ ਇਹਨਾਂ ਨੂੰ ਰੇਡੀਓ ਤੋਂ ਸੁਣਦੀ ਸੀ ਫਿਰ ਟੇਪ ਰਿਕੋਡਰ ਆਏ ਫਿਰ ਅਸੀਂ ਇਹਨਾਂ ਨੂੰ ਦੂਰਦਰਸ਼ਨ ਚੈਨਲ ਤੋਂ ਸੁਣਦੇ ਰਹੇ ਹਾਂ ਹੁਣ ਸਾਡੇ ਕੋਲ ਯੂਟਿਊਬ ਚੈਨਲਜ ਆ ਗਏ ਨੇ ਸਾਡੇ ਆਪਣੇ ਸਮਾਰਟਫ਼ੋਨਸ ਆ ਗਏ ਨੇ ਉਹਨਾਂ ਤੋਂ ਸੁਣਦੇ ਹਾਂ